ਪਸ਼ੂਆਂ ਦਾ ਬੀਮਾ ਕਰਵਾਉਣਾ ਜ਼ਰੂਰੀ ਹੈ ਕਿਉਂਕਿ ਜੋ ਅੱਜ ਕੱਲ੍ਹ ਪਸ਼ੂ ਬਹੁਤ ਕੀਮਤ ਦੇ ਹਨ ਜੇਕਰ ਕੋਈ ਪਸ਼ੂਆਂ ਨੂੰ ਕੋਈ ਬਿਮਾਰੀ ਹੋ ਜਾਂਦੀ ਹੈ ਜਾਂ ਕਿਸੇ ਕਾਰਨ ਪਸ਼ੂ ਦੀ ਮੌਤ ਹੋ ਜਾਂਦੀ ਹੈ ਸੋ ਜੋ ਬੀਮਾ ਕਰਵਾਇਆ ਹੁੰਦਾ ਹੈ ਉਸ ਦਾ ਲਾਭ ਪਸ਼ੂਆਂ ਦੇ ਮਾਲਕ ਨੂੰ ਮਿਲ ਜਾਂਦਾ ਹੈ ਬੀਮਾ ਕਰਵਾਉਣ ਦੇ ਇਹ ਲਾਭ ਹਨ ਕਿਉਂਕਿ ਉਸ ਦਾ ਫਿਰ ਜੋ ਪਸ਼ੂਆਂ ਦਾ ਮਾਲਕ ਹੈ ਉਸ ਦਾ ਜ਼ਿਆਦੇ ਨੁਕਸਾਨ ਨਹੀਂ ਹੁੰਦਾ ਅਤੇ ਪਸ਼ੂਆਂ ਦੇ ਬੀਮੇ ਕਰਵਾ ਕੇ ਬਹੁਤ ਲੋਕ ਪਸ਼ੂ ਖਰੀਦ ਰਹੇ ਹਨ ਅਤੇ ਬੀਮੇ ਕਰਵਾ ਰਹੇ ਹਨ ਬੀਮਾ ਕਰਵਾਉਣਾ ਤਾਂ ਲਾਭਦਾਇਕ ਹੈ ਤਾਂ ਜ਼ਰੂਰੀ ਹੈ ਕਿ ਕੱਲ ਨੂੰ ਕੋਈ ਪਸ਼ੂ ਮਰ ਜਾਂਦਾ ਹੈ ਮੌਤ ਹੋ ਜਾਂਦੀ ਹੈ ਕਿਸੇ ਕਾਰਨ ਸੋ ਉਹ ਬੀਮੇ ਦੇ ਵਿੱਚ ਉਹਨੂੰ ਮਾਲਕ ਨੂੰ ਪੈਸੇ ਮਿਲ ਜਾਂਦੇ ਹਨ